ਮੈਂ ਪੰਜਾਬ ਦੀ ਜੰਮੀ ਪਲੀ ਹਾਂ ਅਤੇ ਮੇਰਾ ਸੱਭਿਆਚਾਰ ਵੀ ਪੰਜਾਬ ਨਾਲ ਹੀ ਜੁੜਿਆ ਹੋਇਆ ਹੈ ਮੈਂ ਪੰਜਾਬੀ ਸੱਭਿਆਚਾਰ ਤੋਂ ਹੀ ਬਿਲੋਂਗ ਕਰਦੀ ਹਾਂ ਪਰ ਮੈਂ ਹੁਣ ਜਿੱਥੇ ਕੋਲੇਜ ਵਿੱਚ ਪੜ੍ਹਦੀ ਹਾਂ ਉੱਥੇ ਬਹੁਤ ਸਾਰੇ ਲੋਕ ਅਲੱਗ ਅਲੱਗ ਸੱਭਿਆਚਾਰ ਤੋਂ ਆ ਜਿਵੇਂ ਕਿ ਕੁਛ ਲੋਕ ਬਿਹਾਰੀ ਬਿਹਾਰੀ ਆ ਬੰਗਾਲੀ ਹੋ ਗਏ ਹਿਮਾਚਲੀ ਹੋ ਗਏ ਇਹਨਾਂ ਦਾ ਆਪਣਾ ਆਪਣਾ ਅਲੱਗ ਅਲੱਗ ਸੱਭਿਆਚਾਰ ਹੈ ਇੱਦਾਂ ਮੇਰੇ ਸੱਭਿਆਚਾਰ ਵਿੱਚ ਅਸੀਂ ਭੰਗੜਾ ਕਰਦੇ ਹਾਂ ਉੱਦਾਂ ਹੀ ਹਿਮਾਚਲੀ ਨਾਟੀ ਕਰਦੇ ਆ ਅਤੇ ਬੰਗਾਲੀ ਦੁਰਗਾ ਪੂਜਾ ਜੇ ਦੁਪਾਚੀ ਕਰਦੇ ਆ ਇੱਦਾਂ ਹੀ ਇੰਟਰਨੈਸ਼ਨਲ ਸਟੂਡੈਂਟਸ ਵੀ ਆ ਉਹਨਾਂ ਦਾ ਆਪਣਾ ਅਲੱਗ ਸੱਭਿਆਚਾਰ ਹੈ ਇਹ ਇਨ੍ਹਾਂ ਦਾ ਆਪਣਾ ਆਪਣਾ ਖਾਣਾ ਪੀਣਾ ਸਭ ਦਾ ਜਿੱਦਾਂ ਸਾਡਾ ਖਾਣਾ ਪੀਣਾ ਬਹੁਤ ਅਲੱਗ ਹੈ ਅਤੇ ਉਨ੍ਹਾਂ ਦਾ ਅਲੱਗ ਹੈ ਫਿਰ ਪਹਿਰਾਵਾ ਵੀ ਇੱਦਾਂ ਹੀ ਸਾਡਾ ਅਲੱਗ ਅਤੇ ਉਹਨਾਂ ਦਾ ਅਲੱਗ ਹੈ ਜਿੱਦਾਂ ਕਿ ਹੁਣ ਮੈਂ ਪੰਜਾਬ ਤੋਂ ਬਿਲੋਂਗ ਕਰਦੀ ਹਾਂ ਤਾਂ ਅਸੀਂ ਜ਼ਿਆਦਾ ਪ੍ਰੈਫਰ ਸੂਟ ਨੂੰ ਹੀ ਕਰਦੇ ਹਾਂ ਕਿ ਸਾਡਾ ਸੱਭਿਆਚਾਰ ਹੈ ਅਤੇ ਜਿੱਦਾਂ ਇਡਰਨੈ ਇੰਟਰਨੈਸ਼ਨਲ ਸਟੂਡੈਂਟਸ ਹੋ ਗਏ ਉਹ ਵੈਸਟਨਸ ਜ਼ਿਆਦਾ ਪਾਉਂਦੇ ਆ ਫਿਰ ਕੁਛ ਲੋਕ ਸਾੜੀ ਵੀ ਜ਼ਿਆਦਾ ਮਤਲਬ ਪਾਉਣਾ ਉਹ ਕਰਦੇ ਆ ਪ੍ਰੈਫਰ ਕਿਉਂਕਿ ਉਹ ਦਾ ਸੱਭਿਆਚਾਰ ਸਾੜੀ ਨਾਲ ਹੀ ਆ ਸਭ ਦਾ ਆਪਣਾ ਆਪਣਾ ਸੱਭਿਆਚਾਰ ਹੈ